ਹੈਲੋ ਹਾਂ ਭੈਣੇ ਮੈਂ ਫਿਰੋਜ਼ਪੁਰ ਆਇਆ ਹੋਇਆ ਹਾਂ ਹਾਂ ਹਾਂ ਹੁਣ ਮੇਰੀ ਬਦਲੀ ਨਾ ਫਿਰੋਜ਼ਪੁਰ ਈ ਹੋ ਗਈ ਹੈ ਹਾਂ ਹੁਣ ਮੈਂ ਇੱਥੇ ਹੀ ਰਿਹਾ ਕਰਨਾ ਹਾਂ ਹੁਣ ਤਾਂ ਮੈਂ ਹੋਟਲ ਦੇ ਵਿੱਚ ਰੂਮ ਲਿਆ ਹੈ ਅਤੇ ਬਸ ਮੈਂ ਪੀ ਜੀ ਮੈਨੂੰ ਦੱਸ ਦੇ ਕੋਈ ਕਿੱਥੇ ਵਧੀਆ ਮਿਲੇਗਾ

ਪੈਸੇ ਦਾ ਤਾਂ ਕੋਈ ਚੱਕਰ ਨਹੀਂ ਬਸ ਇਹ ਹੈ ਰੋਣਾ ਖਾਲੀ ਜਗ੍ਹਾ ਹੋਵੇ ਬਸ ਹੁਣ ਮੈਨੂੰ ਇਹ ਦੱਸ ਇੱਥੇ ਤਾਜ਼ੀ ਸਬਜ਼ੀ ਕਿੱਥੇ ਮਿਲਦੀਆਂ ਨੇ ਹਾਂ ਠੀਕ ਆ ਮੈਂ ਤੈਨੂੰ ਪਤਾ ਹੀ ਤਾਂ ਮੈਂ ਨਾ ਮੈਨੂੰ ਤਾਜ਼ਾ ਖਾਣਾ ਬਹੁਤ ਚੰਗਾ ਲੱਗਦਾ ਅਤੇ ਬਸ ਮੈਂ ਹੁਣ ਤਾਜ਼ਾ ਖਾਣਾ ਹੀ ਖਾਣਾ ਚਾਹੁੰਦਾ ਅਤੇ ਮੈਂ ਸਬਜ਼ੀ ਉਧਰੋਂ ਲਿਆਇਆ ਕਰਾਂਗਾ ਹੁੰ ਅਤੇ ਭੈਣੇ ਹੁਣ ਤੂੰ ਮੈਨੂੰ ਇਹ ਦੱਸ ਇੱਥੇ ਫੇਮਸ ਗੁਰਦੁਆਰਾ ਹੈਗਾ ਹੈ ਉਹ ਕਿੱਥੇ ਕਰਕੇ ਪੈਂਦਾ ਹਾਂ ਭੈਣ ਠੀਕ ਹੈ ਭੈਣੇ ਓਕੇ ਭੈਣੇ ਇੱਥੇ ਕਬੀਲੇ ਹਾਂ ਹਾਂ ਪੜ੍ਹਾਈ ਦੇ ਨਾਲ ਨਾਲ ਵੀ ਜੋਬ ਵੀ ਕਰ ਰਿਹਾ ਮੈਂ ਹਾਂ ਹਾਂ ਇਹਦੇ ਨਾਲ ਮੇਰਾ ਸਾਰਾ ਖਰਚਾ ਆਪਣੇ ਆਪ ਹੀ ਨਿਕਲ ਜਾਂਦਾ ਹੁਣ ਇਹ ਭੈਣੇ ਮੈਂ ਨਾਲ ਦੇ ਨਾਲ ਐੱਮਕੋਮ ਕਰ ਰਿਹਾ ਨਹੀਂ ਬੁਕਸਾਂ ਮੈਂ ਕੁਝ ਲੈਣੀਆਂ ਨੇ ਕੁਝ ਕਾਲਜ ਵਾਲਿਆਂ ਦੇ ਦਿ ਦਿੱਤੀਆਂ ਸਨ ਅਤੇ ਮੈਨੂੰ ਇਹ ਵੀ ਦੱਸ ਹਾਂ ਹਾਂ ਹਾਂ ਹਾਂ ਅਕ ਓਕੇ ਠੀਕ ਹੈ ਜੇ ਸੈਕਿੰਡ ਹੈਂਡ ਮਿਲੀਆਂ ਤਾਂ ਉਹ ਠੀਕ ਨਹੀਂ ਤਾਂ ਫਿਰ ਨਵੀਆਂ ਤਾਂ ਲੈ ਹੀ ਲਵਾਂਗਾ ਬਸ ਅਪਡੇਟਿਡ ਹੋਣ ਕਿਤਾਬਾਂ ਸਾਰੀਆਂ ਉਹ ਤਾਂ ਕੋਈ ਚੱਕਰ ਨਹੀਂ ਪੁਰਾਣੀਆਂ ਵੀ ਹੋਣ ਤਾਂ ਮੈਂ ਤਾਂ ਪੜ੍ਹਨਾ ਹੀ ਆ ਬਸ ਹਾਂ ਮੈਂ ਗੁਰੂ ਨਾਨਕ ਕੋਲਜ ਤੇ ਕਰਵਾਈ ਸੀ ਓਪਨ ਐਡਮਿਸ਼ਨ ਅਤੇ ਨਾਲ ਦੀ ਨਾਲ ਮੈਂ ਜੋਬ ਵੀ ਕਰ ਰਿਹਾ ਨਾ ਇਸ ਕਰਕੇ ਹਾਂ ਨਾਲ ਦੀ ਨਾਲ ਨਾ ਮਨ ਵੀ ਲੱਗਿਆ ਰਹਿੰਦਾ ਅਤੇ ਨਾਲ ਦੀ ਨਾਲ ਕੰਮ ਵੀ ਹੁੰਦਾ ਰਹਿੰਦਾ ਅੱਛਾ ਭੈਣੇ ਠੀਕ ਹੈ ਭੈਣੇ ਮੈਨੂੰ ਦੱਸਦੀ ਜਦੋਂ ਜਾਣਾ ਹੋਵੇਗਾ ਕੋਈ ਗੱਲ ਨਹੀਂ ਭੈਣੇ ਧੰਨਵਾਦ ਭੈਣ